ਇੱਥੇ ਲੋਕ ਜ਼ਿਆਦਾਤਰ ਫਸਲਾਂ ਜਿਵੇਂ ਕਿ ਲਗਾ ਲਉ ਝੋਨਾ ਹੋ ਗਿਆ ਕਣਕ ਹੋ ਗਿਆ ਅਤੇ ਆਲੂ ਹੋ ਗਿਆ ਇਸ ਤਰੀਕੇ ਦੀ ਜ਼ਿਆਦਾਤਰ ਖੇਤੀ ਕਰਦੇ ਆ ਜੋ ਕਿ ਫਸਲਾਂ ਇਹ ਕਿਸਾਨ ਨੂੰ ਕਾਫੀ ਲਾਭਦਾਇਕ ਫਾਇਦਾ ਕਰਦੀਆਂ ਹਨ ਅਤੇ ਉਸ ਤੋਂ ਬਾਅਦ ਪਸ਼ੂ ਲਗਾ ਲਉ ਇੱਥੇ ਜ਼ਿਆਦਾਤਰ ਪਸ਼ੂ ਦੀ ਖੇਤੀ ਮੱਝ ਮੱਝ ਅਤੇ ਬੱਕਰੀਆਂ ਦੀ ਕੀਤੀ ਜਾਂਦੀ ਹੈ ਅਤੇ ਗਾਂਵਾਂ ਦੀ ਘੱਟ ਤੋਂ ਘੱਟ ਕਰਦੇ ਹਨ ਅਤੇ ਹੁਣ ਕਾਫੀ ਜ਼ਿਆਦਾ ਜ਼ਿਆਦਾ ਪਸ਼ੂ ਦੀ ਖੇਤੀ ਮੱਝਾਂ ਔਰ ਬੱਕਰੀਆਂ ਦੀ ਕੀਤੀ ਜਾਂਦੀ ਹੈ